ਸਤਿ ਸ਼੍ਰੀ ਅਕਾਲ ਜੀ ਮੈਨੂੰ ਔਨਲਾਈਨ ਜਿਹੜੀ ਸ਼ੋਪਿੰਗ ਹੈ ਇਹਦਾ ਬਹੁਤ ਜ਼ਿਆਦਾ ਸ਼ੌਕ ਪੈ ਗਿਆ ਸੀਗਾ ਜਦੋਂ ਮੈਂ ਉਹਦਾ ਪਹਿਲਾ ਪ੍ਰੋਡਕਟ ਇੱਥੋਂ ਖਰੀਦਿਆ ਸੀਗਾ ਅਤੇ ਮੈਂ ਉਹ ਪ੍ਰੋਡਕਟ ਲੱਭਣ ਦੀ ਬਹੁਤ ਬਹੁਤ ਕੋਸ਼ਿਸ਼ ਕੀਤੀ ਬਟ ਉਹ ਮੈਨੂੰ ਨਹੀਂ ਮਿਲਿਆ ਹੈ ਨਾ ਉਹ ਬੁੱਕ ਮੈਨੂੰ ਕਿਤੋਂ ਵੀ ਜਿਹੜੀ ਆ ਅਵੇਲੇਬਲ ਨਹੀਂ ਹੋਈ ਸੀਗੀ ਅਤੇ ਪਰ ਉਹ ਮੈਨੂੰ ਚਾਹੀਦੀ ਜ਼ਰੂਰ ਸੀ ਵੀ ਮੈਂ ਉਹਨੂੰ ਪੜ੍ਹਨਾ ਚਾਹੁੰਦੀ ਸੀ ਮੇਰੀ ਫੇਵਰੇਟ ਰਾਈਟਰ ਦੀ ਸੀ ਅੰਮ੍ਰਿਤਾ ਪ੍ਰੀਤਮ ਜੀ ਦੀ ਸੀ ਅਤੇ ਫੇਰ ਮੈਂ ਮੇਰੀ ਕਿਸੇ ਦੋਸਤ ਨੇ ਦੱਸਿਆ ਵੀ ਤੂੰ ਐਦਾਂ ਕਰ ਫਲਿੱਪਕਾਰਟ 'ਤੇ ਜਾ ਉੱਥੇ ਤੇਰਾ ਅੰਮ੍ਰਿਤਾ ਪ੍ਰੀਤਮ ਦੀਆਂ ਸਾਰੀਆਂ ਬੁੱਕਸ ਅਵੇਲੇਬਲ ਨੇ ਨਾਲੇ ਤੈਨੂੰ ਡਿਸਕਾਊਂਟ ਮਿਲ ਜਾਊਗਾ ਜਦੋਂ ਮੈਂ ਉੱਥੇ ਫਸਟ ਟਾਈਮ ਗਈ ਅਤੇ ਆਪਦਾ ਉਹਨੂੰ ਐਪ ਨੂੰ ਡਾਊਨਲੋਡ ਕੀਤਾ ਆਪਣੇ ਫੋਨ 'ਚ ਤਾਂ ਦੇਖਿਆ ਅੰਮ੍ਰਿਤਾ ਪ੍ਰੀਤਮ ਦੀਆਂ ਬਹੁਤ ਸਾਰੀਆਂ ਬੁੱਕਸ ਜੋ ਮੈਨੂੰ ਇੱਥੇ ਮਿਲੀਆਂ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਮੈਂ ਆਪਦਾ ਫਸਟ ਜਿਹੜਾ ਉੱਥੋਂ ਪ੍ਰੋਡਕਟ ਮੰਗਵਾਇਆ ਸੀ ਪਿੰਜਰ ਨਾਵਲ ਮੰਗਵਾਇਆ ਜਿਹਨੂੰ ਮੈਂ ਬਹੁਤ ਟਾਈਮ ਆਪਣੇ ਨਾਲ ਜਿਹੜਾ ਸੀਗਾ ਪੜ੍ਹਿਆ ਉਹਨੂੰ ਉਹਦੇ ਨਾਲ ਬਹੁਤ ਖੁਸ਼ ਹੋਈ ਸੀ ਉਸ ਪ੍ਰੋਡਕਟ ਤੋਂ ਵੀ ਮੈਨੂੰ ਬਹੁਤ ਵਧੀਆ ਇਹ ਐਪ ਲੱਗਿਆ ਇਸ ਤੋਂ ਬਾਅਦ ਮੈਂ ਬਹੁਤ ਸਾਰੀਆਂ ਹੋਰ ਵੀ ਨੋਵਲਸ ਜਾਂ ਬੁੱਕਸ ਇਸ ਤੋਂ ਮੰਗਵਾਈਆਂ ਸੀਗੀਆਂ ਅਤੇ ਪਰ ਮੈਨੂੰ ਇਹ ਜਿਹੜਾ ਨਾਵਲ ਸੀਗਾ ਮੈਨੂੰ ਇਹ ਨਾਲ ਬਹੁਤ ਵਧੀਆ ਲੱਗਿਆ ਸੀ ਐਮਾਜ਼ੋਨ ਫਲਿੱਪਕਾਰਟ ਜਿਹੜਾ ਐਮਾਜ਼ੋਨ ਫਲਿੱਪਕਾਰਟ ਮੈਂ ਪਹਿਲੀ ਵਾਰੀ ਯੂਜ ਕੀਤਾ ਸੀ ਇਸ ਨਾਲ ਧੰਨਵਾਦ